ਪੰਜਾਬ ਵਿੱਚ ਰਾਜਕ ਰਾਜਨੀਤਿਕ ਪ੍ਰਣਾਲੀ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਬਹੁਤ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਜੇਕਰ ਪੰਜਾਬ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਆਮ ਲੋਕਾਂ ਦੇ ਸੋਚਣ ਦੇ ਮੁਤਾਬਕ ਚੱਲ ਰਹੀ ਹੋਵੇ ਆਮ ਲੋਕਾਂ ਦੇ ਮੁਤਾਬਕ ਸਰਕਾਰਾਂ ਚੱਲਦੀਆਂ ਹੋਣ ਆਮ ਲੋਕਾਂ ਦੇ ਮੁਤਾਬਕ ਸਰਕਾਰਾਂ ਚੁਣੀਆਂ ਹੋਣ ਅਤੇ ਆਮ ਲੋਕਾਂ ਦ ਦੇ ਮੁਤਾਬਕ ਹੀ ਹੈ ਸਰਕਾਰਾਂ ਕੰਮ ਕਰਦੀਆਂ ਹੋਣ ਤਾਂ ਜਿਹੜਾ ਵਾਤਾਵਰਨ ਜਿਹੜੀ ਵਾਤਾਵਰਨ ਦੀ ਸੁਰੱਖਿਆ ਉਹਦੇ ਵਾਸਤੇ ਸਰਕਾਰਾਂ ਕੰਮ ਕਰਦੀਆਂ ਨੇ ਅਤੇ ਜਿਹੜੇ ਵਿਕਾਸ ਦੇ ਮੁੱਦੇ ਨੇ ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਂਦੇ ਨੇ ਅਤੇ ਜੇਕਰ ਸਰ ਪ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸਰਕਾਰਾਂ ਇਸ ਤਰ੍ਹਾਂ ਦੇ ਲੋਕ ਸੱਤਾ ਦੇ ਵਿੱਚ ਆਉਣਗੇ ਜਿਨ੍ਹਾਂ ਨੇ ਕਦੇ ਵੀ ਇਸ ਚੀਜ਼ ਨੂੰ ਪ੍ਰਮੁ ਪ੍ਰਮੁੱਖ ਨਹੀਂ ਮੰਨਿਆ ਕਿ ਉਹਨਾਂ ਨੇ ਦੇਸ਼ ਪੰਜਾਬ ਵਾਸਤੇ ਆਪਣੇ ਰਾਜ ਵਾਸਤੇ ਕੰਮ ਕਰਨਾ ਅਤੇ ਉਹਨਾਂ ਦੇ ਵਾਸਤੇ ਹੋਰ ਚੀਜ਼ਾਂ ਦੀ ਮਹੱਤਤਾ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਮਹੱਤਤਾ ਦਿਤ ਦੇਣੀ ਹੈ ਅਤੇ ਆਮ ਲੋਕਾਂ ਦੇ ਵਿੱਚ ਵਿਚਰਨਾ ਨਾ ਹੀ ਨਹੀਂ ਹੈਗਾ ਤਾਂ ਉਹਦੇ ਨਾਲ ਤਾਂ ਫਿਰ ਇਹ ਜਿਹੜੀ ਸ ਸ ਜਿਹੜੀ ਵਾਤਾਵਰਨ ਸੁਰੱਖਿਆ ਉਹਦੇ ਵਿੱਚ ਵੀ ਖੜਲ ਪੈਂਦਾ ਅਤੇ ਵਿਕਾਸ ਦਾ ਮੁੱਦਾ ਉਹ ਵੀ ਪਿੱਛੇ ਰਹਿ ਜਾਊਗਾ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਵੀ ਪੰਜਾਬ 'ਚ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਰਾਜਨੀਤਿਕ ਸਿਸਟਮ ਹੈ ਉਹ ਸਹੀ ਤਰੀਕੇ ਨਾਲ ਚੱਲੇ ਸਹੀ ਤਰੀਕੇ ਨਾਲ ਚੋਣ ਹੋਵੇ ਸਰਕਾਰ ਪੰਜ ਸਾਲ ਚੱਲੇ ਅਤੇ ਪੰਜ ਸਾਲ ਸਰਕਾਰ ਚੱਲਣ ਦੇ ਨਾਲ ਨਾਲ ਜਿਹੜੇ ਜਿੰਨੇ ਵੀ ਜਵਾਲਨਤ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਲੋਕ ਆਮ ਗੱਲ ਕਰਦੇ ਨੇ ਉਹਨਾਂ ਮੁੱਦਿਆਂ ਦੀ ਗੱਲ ਸਰਕਾਰ ਵੀ ਕਰੇ ਉਹਨਾਂ ਮੁੱਦਿਆਂ ਦੀ ਗੱਲ ਰਾਜਨੀਤਿਕ ਪਾਰਟੀਆਂ ਕਰਨ ਉਹਨਾਂ ਮੁੱਦਿਆਂ ਦੀ ਗੱਲ ਸੱਤਾ ਵਿੱਚ ਬੈਠੀ ਪਾਰਟੀ ਕਰੇ ਉਹਨਾਂ ਮੁੱਦਿਆਂ ਦੀ ਗੱਲ ਵਿਰੋਧੀ ਧਿਰ ਕਰੇ ਤਾਂ ਹੀ ਜਾ ਕੇ ਕਿਤੇ ਜਿਹੜੇ ਵਾਤਾਵਰਨ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਮੁੱਦੇ ਨੇ ਉਹ ਹੱਲ ਹੋ ਸਕਦੇ ਨੇ ਇਹਨਾਂ ਨੂੰ ਹੱਲ ਕਰਨ ਵਾਸਤੇ ਇਮਾਨਦਾਰੀ ਦੀ ਜ਼ਰੂਰਤ ਹੈ ਅਤੇ ਜੇਕਰ ਇਮਾਨਦਾਰੀ ਅਤੇ ਇਮਾਨਦਾਰੀ ਨਾਲ ਵਿਕਾਸ ਵੀ ਹੋਊਗਾ ਅਤੇ ਜੇਕਰ ਵਿਕਾਸ ਹੋਊਗਾ ਤਾਂ ਆਮ ਲੋਕ ਆਮ ਸ਼ਹਿਰੀ ਆਮ ਪੇਂਡੂ ਲੋਕ ਆਪਣੀ ਜਿਹੜੀ ਸੁਰੱਖਿਆ ਉਹਨੂੰ ਵਧੀਆ ਤਰੀਕੇ ਨਾਲ ਮਹਿਸੂਸ ਕਰਨਗੇ ਅਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਹੜਾ ਸਾਡਾ ਜਿਹੜਾ ਦੇਸ਼ ਹੈ ਸਾਡਾ ਸਟੇਟ ਹੈ ਸਾਡਾ ਰਾਜ ਹੈ ਉਹ ਤਰੱਕੀ ਕਰ ਰਿਹਾ ਅਤੇ ਤਰੱਕੀ ਦੇ ਨਾਲ ਹੀ ਆਮ ਬੰਦੇ ਦੀ ਜਿਹੜੀ ਰੋਜ਼ਾਨਾ ਜ਼ਿੰਦਗੀ ਹੈ ਉਹ ਵੀ ਵਧੀਆ ਹੁੰਦੀ ਹੈ ਅਤੇ ਜਿਹੜੀ ਆਮ ਬੰਦੇ ਦੀ ਜਿਹੜੀ ਰੋਜ਼ਾਨਾ ਜਾਂ ਮਹੀਨੇ ਦੀ ਜਾਂ ਸਾਲਾਨਾ ਜਿਹੜੀ ਆਮਦਨ ਉਹਦੇ ਵਿੱਚ ਵਾਧਾ ਹੁੰਦਾ ਅਤੇ ਜਿਸ ਕਿਸੇ ਬੰਦੇ ਦੀ ਜਾਂ ਕਿਸੇ ਵਿਅਕਤੀ ਦੀ ਕਿਸੇ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਤਾਂ ਖੁਸ਼ੀਆਂ ਲੈ ਕੇ ਆਵੇਗਾ ਅਤੇ ਇਹਨਾਂ ਖੁਸ਼ੀਆਂ ਦੇ ਨਾਲ ਪੂਰਾ ਸਟੇਟ ਪੂਰਾ ਅ ਦੇਸ਼ ਪੂਰੀ ਦੁਨੀਆ ਦੇ ਵਿੱਚ ਇਹ ਇਹ ਇਹਦੀਆਂ ਚਰਚਾਵਾਂ ਹੋਣਗੀਆਂ ਅਤੇ ਚਰਚਾਵਾਂ ਹਮੇਸ਼ਾ ਹੀ ਚੰਗੀਆਂ ਹੀ ਹੋਣੀਆਂ ਚਾਹੀਦੀਆਂ ਨੇ ਧੰਨਵਾਦ